ਹੈਲੋ ਹੈਲੋ ਹਾਂਜੀ ਸਸ ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ ਠੀਕ ਹੋ ਜੀ ਵਹ ਬਹੁਤ ਵਧੀਆ ਤੁਸੀਂ ਸੁਣਾਉ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੱਚੇ ਵੱਡਾ ਬੱਚਾ ਤਾਂ ਜੀ ਆਪਣੇ ਬਾਰਵੀਂ ਕਲਾਸ ਵਿੱਚ ਪੜ੍ਹਦਾ ਡਵਾਈਨ ਲਾਈਟ ਸਕੂਲ ਦੇ ਵਿੱਚ ਆਪਣਾ ਜਿਹੜਾ ਛੋਟਾ ਬੱਚਾ ਆਪਣੇ ਜੀਸਸ ਸਕੂਲ ਨਾਲ ਹੈ ਉਹਦੇ ਉਹ ਪੜ੍ਹਦਾ ਅੱਛਾ ਤੁਹਾ ਹਾਂਜੀ ਹਾਂਜੀ ਅਤੇ ਤੁਹਾਡੇ ਬੱਚੇ ਅੱਛਾ ਜੀ ਹਾਂਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਇੱਥੇ ਮੇਰੇ ਖਿਆਲ ਨਾਲ ਬਾਕੀਆਂ ਦੇ ਮੁਕਾਬਲੇ ਬੱਚੇ ਕੁਛ ਠੀਕ ਪੜ੍ਹਦੇ ਨੇ ਇਹਨਾਂ ਦਾ ਜਿਹੜਾ ਸਟਾਫ ਹੈ ਉਹ ਵੀ ਬਾਕੀ ਸਕੂਲਾਂ ਨਾਲੋਂ ਬਿਹਤਰ ਹੈ ਅਤੇ ਹਾਂਜੀ ਹਾਂਜੀ ਹਾਂ ਬਾਕੀ ਕ੍ਰਿਸ਼ਚਨ ਕਮਿਊਨਿਟੀ ਹੈਗੀ ਉਹਨਾਂ ਦੀ ਅੱਛਾ ਬੱਚਿਆਂ ਨੂੰ ਪੜ੍ਹਾਉਂਦੇ ਨੇ ਬਾਕੀ ਮਾਪਿਆਂ ਨਾਲ ਵੀ ਉਹਨਾਂ ਦਾ ਕਾਫੀ ਮਿਲਵਰਤਨ ਅੱਛਾ ਵਧੀਆ ਹਾਂਜੀ ਹਾਂਜੀ ਹਾਂਜੀ ਇਹ ਆਪਣੇ ਸੁਭਾਸ਼ ਜੀ ਨੇ ਇੱਥੇ ਸਰਹਿੰਦ ਤੋਂ ਹੀ ਸਰਹਿੰਦ ਮੰਡੀ ਤੋਂ ਨੇ ਇਹਨਾਂ ਦਾ ਸਕੂਲ ਹੈ ਇਹ ਉੱਥੋਂ ਦੇ ਚੇਅਰਮੈਨ ਇਹ ਨੇ ਆਪਣੇ ਸ਼ੁਭਾਜ ਜੀ ਨੇ ਆਪਣਾ ਇਹ ਆਪਣੇ ਪੁਰਾਣੇ ਪ੍ਰੋਫੈਸਰ ਸੀ ਪਹਿਲਾਂ ਹਾਂਜੀ ਇਹਨਾਂ ਨੇ ਫਿਰ ਆਪਣਾ ਉਹੀ ਲਾਈਨ ਸ਼ੁਰੂ ਕਰ ਲੀਤੀ ਆ ਆਪਣੇ ਇਹਨਾਂ ਦੀ ਹਾਂਜੀ ਅ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹਨਾਂ ਦੀ ਫੀਸਾਂ ਵੀ ਥੋੜ੍ਹੀਆਂ ਵਾਜਬ ਨੇ ਬਾਕੀਆਂ ਨਾਲੋਂ ਕਿਉਂਕਿ ਓ ਪੀ ਬਾਂਸਲ ਦੀ ਜੇ ਫੀਸ ਦੀ ਆਪਾਂ ਗੱਲ ਕਰੀਏ ਉਨ੍ਹਾਂ ਦੀ ਜੀ ਥੋੜ੍ਹੀ ਫੀਸ ਜ਼ਿਆਦਾ ਹੈਗੀ ਹੈ ਇਹਨਾਂ ਦੇ ਮੁਕਾਬਲੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਆ ਜੀ ਠੀਕ ਹੈ ਸਤਿ ਸ਼੍ਰੀ ਅਕਾਲ